ਹੈਲੋ ਜੀ ਜੀ ਮੈਂ ਯਸ਼ਿਕਾ ਬੋਲ ਰਹੀ ਹਾਂ ਜਿਹਨਾਂ ਦੇ ਘਰ ਤੁਸੀਂ ਦੁਧ ਦੇਣ ਆਉਂਦੇ ਹੋ ਜੀ ਕੀ ਹੋ ਗਿਆ ਦੁੱਧ ਹੀ ਖਰਾਬ ਨਿਕਲਿਆ ਸਾਰਾ ਨਹੀਂ ਜੀ ਨਹੀਂ ਜੀ ਅੱਜ ਅਸੀਂ ਸਵੇਰੇ ਉਬਾਲਾ ਦਿੱਤਾ ਤਾਂ ਸਾਰਾ ਦੁੱਧ ਹੀ ਫਟ ਗਿਆ ਨਹੀਂ ਜੀ ਅਸੀਂ ਹਜੇ ਦੁੱਧ ਲਗਾਏ ਨੂੰ ਟਾਇਮ ਹੀ ਕਿੰਨਾ ਕੁ ਹੋਇਆ ਅਸੀਂ ਪਿਛਲੇ ਦੋਧੀਆਂ ਨੂੰ ਤਾਂ ਹੀ ਹਟਾਇਆ ਸੀ ਕਿ ਤੁਹਾਡਾ ਦੁੱਧ ਵਧੀਆ ਹੁੰਦਾ ਅਤੇ ਹਜੇ ਪੰਜ ਦਿਨ ਵੀ ਨਹੀਂ ਹੋਏ ਨਹੀਂ ਜੀ ਤੁਸੀਂ ਆਪਣਾ ਦੁੱਧ ਵੇਖ ਕੇ ਦਿੱਤਾ ਕਰੋ ਐਵੇਂ ਕੰਮ ਨਹੀਂ ਬਣੇਗਾ ਅਸੀਂ ਸਾਰਾ ਕੁਝ ਹੈ ਵੇ ਅਸੀਂ ਸਾਰਾ ਐਵੇਂ ਹੀ ਕਰਦੇ ਹਾਂ ਜੀ ਅੱਜ ਦੀ ਗੱਲ ਥੋੜ੍ਹੀ ਹੈ ਕਈ ਸਾਲ ਹੋ ਗਿਆ ਐਵੇਂ ਕਰਦੇ ਨੂੰ ਹਾਂਜੀ ਮਲਾਈ ਵੀ ਨਹੀਂ ਆ ਰਹੀ ਜੀ ਦੋ ਦਿਨਾਂ ਤੋਂ ਤਾਂ ਸੋਚ ਰਹੀ ਸੀ ਕਿ ਤੁਹਾਨੂੰ ਕਹਾਂਗੇ ਕਹਾਂਗੇ ਚੱਲ ਅਸੀਂ ਚੁੱਪ ਸੀ ਦੋ ਦਿਨਾਂ ਤੋਂ ਅੱਜ ਤਾਂ ਦੁੱਧ ਹੀ ਫਟ ਗਿਆ ਹਾਂਜੀ ਚੱਲੋ ਕੋਈ ਨਾ ਹੁਣ ਤੁਸੀਂ ਧਿਆਨ ਰੱਖਿਓ ਅੱਗੇ ਤੋਂ ਇਹੋ ਜਿਹੀ ਗਲਤੀ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਮੈਂ ਦੁੱਧ ਹਟਾ ਲੈਣਾ ਤੁਹਾਡੇ ਤੋਂ ਠੀਕ ਹੈ ਜੀ